ਬ੍ਰਹਿਮੰਡ ਦਾ ਅਧਿਐਨ ਕਰਨ ਕੇ ਅਸੀਂ ਸਿੱਖ ਸਕਦੇ ਹਾਂ ਬ੍ਰਹਿਮੰਡ ਦੇ ਵਿੱਚ ਸਾਨੂੰ ਗ੍ਰਹਿਆਂ ਦੇ ਬਾਰੇ ਜਾਣਕਾਰੀ ਪ੍ਰਾਪਤ ਹੋ ਸਕਦੀ ਹੈ ਅਤੇ ਗ੍ਰਹਿਆਂ ਦੇ ਉੱਤੇ ਅਸੀਂ ਇੱਕ ਨਵਾਂ ਜੀਵਨ ਸੰਭਵ ਕਰ ਸਕਦੇ ਹਾਂ ਸਾਡੀ ਪ੍ਰਿਥਵੀ ਦੇ ਉੱਤੇ ਕਾਫ਼ੀ ਪਾਪੂਲਸ਼ ਹੋ ਪੋਪੂਲੇਸ਼ਨ ਹੋਣ ਦੇ ਕਾਰਨ ਸਾਡੇ ਸਾਇੰਟੈਂਸ ਸਾਇੰਟੈਂਸਟ ਹੈਗੇ ਨੇ ਜੋ ਉਹ ਬ੍ਰਹਿਮੰਡ ਦਾ ਬ੍ਰਹਿਮੰਡ ਦੇ ਉੱਤੇ ਖੋਜ ਕਰ ਰਹੇ ਨੇ ਕਿ ਅਸੀਂ ਉੱਥੇ ਵੀ ਇੱਕ ਦੁਨੀਆਦਾਰੀ ਵਸਾ ਸਕੀਏ ਅਤੇ ਅੱਜ ਕੱਲ੍ਹ ਤਾਂ ਪੋਲਿਊਸ਼ਨ ਹੀ ਇੰਨਾ ਹੋ ਚੁੱਕਿਆ ਹੈ ਸਾਨੂੰ ਤਾਰੇ ਅਤੇ ਚੰਦਰਮਾ ਸਾਫ਼ ਨਹੀਂ ਦਿਖਾਈ ਦਿੰਦਾ ਅਤੇ ਪਹਿਲਾਂ ਦੇ ਸਮਿਆਂ ਦੇ ਵਿੱਚ ਕੀ ਹੁੰਦਾ ਸੀ ਸਾਨੂੰ ਤਾਰੇ ਅਤੇ ਚੰਦਰਮਾ ਬਿਲਕੁਲ ਸਾਫ਼ ਸਾਫ਼ ਦਿਖਾਈ ਦਿੰਦੇ ਸੀ ਸੋ ਸਾਨੂੰ ਹੁਣ ਇੰਨੇ ਸਾਫ਼ ਨਹੀਂ ਦਿਖਾਈ ਦਿੰਦੇ